ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਇੱਕ ਆਪਣੀ ਹੀ ਮਹਾਨਤਾ ਹੈ ਸਮੇਂ ਨਾਲ ਇਹ ਪੰਜਾਬ ਦੇ ਤਿਉਹਾਰਾਂ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਿਆ ਹੈ ਹਰੇਕ ਪੰਜਾਬ ਦੇ ਦੁੱਖ ਰੇ ਸ ਸੁਖੜੇ ਦੇ ਵਿੱਚ ਭੰਗੜਾ ਮਹੱਤਵ ਬਣਦਾ ਹੈ ਜਿਸ ਘਰ ਦੇ ਵਿੱਚ ਕੋਈ ਬੱਚਾ ਜੰਮਣ ਤੋਂ ਵਿਆਹ ਤੱਕ ਕੋਈ ਵੀ ਪ੍ਰੋਗਰਾਮ ਦੇ ਵਿੱਚ ਭੰਗੜਾ ਨੱਚਣਾ ਗਾਉਣਾ ਪੰਜਾਬ ਦੇ ਹਰੇਕ ਇਕ ਹਿੱਸੇ ਅਤੇ ਖਿੱਤੇ ਨਾਲ ਜੁੜਿਆ ਹੋਇਆ ਹੈ ਕਿਸੇ ਵੀ ਸਮੇਂ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਜਿਵੇਂ ਸ਼ ਵਿਆਹ ਲੋਹੜੀ ਅਤੇ ਹੋਰ ਵੀ ਕੋਈ ਵੀ ਫੰਕਸ਼ਨ ਹੋਵੇ ਉਸ ਦੇ ਵਿੱਚ ਭੰਗੜੇ ਦਾ ਇੱਕ ਮਹੱਤਵਤਾ ਹੈ ਅਤੇ ਜਿਵੇਂ ਕੋਈ ਤਿਉਹਾਰ ਪੰਜਾਬ ਦੇ ਵਿੱਚ ਮੇਲੇ ਹੋਰ ਵੀ ਕਈ ਕਿਸਮ ਦੇ ਤਿਉਹਾਰ ਦੇ ਵਿੱਚ ਵੀ ਭੰਗੜਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਿਆ ਹੈ ਪੰਜਾਬੀਆਂ ਦੇ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਮਨਾਉਣ ਦੇ ਲਈ ਭੰਗੜਾ ਇੱਕ ਅਹਿਮ ਯੋਗਦਾਨ ਹੈ ਅਤੇ ਇਸ ਨੂੰ ਹਰੇਕ ਪੰਜਾਬੀ ਨੂੰ ਪਾਉਣ ਵਿੱਚ ਖੁਸ਼ੀ ਮਹਿਸੂਸ ਹੁੰਦੀ ਹੈ ਭੰਗੜਾ ਹਰੇਕ ਹੀ ਪੰਜਾਬੀ ਨੂੰ ਆਉਂਦਾ ਹੈ ਅਤੇ ਉਹ ਹਰੇਕ ਖੁਸ਼ੀ ਦੇ ਮੌਕੇ ਵਿੱਚ ਪਾਉਂਦਾ ਹੈ